ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੈ ਪੰਜਾਬ ਦਾ ਜੋ ਮਰਜ਼ੀ ਤਿਉਹਾਰ ਹੋਵੇ ਲੋਹੜੀ ਮਾਘੀ ਵਿਸਾਖੀ ਦਿਵਾਲੀ ਜਾਂ ਕੋਈ ਸ਼ਾਦੀ ਬੱਚਾ ਜੰਮੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤਿਉਹਾਰ ਭੰਗੜਾ ਤਾਂ ਕਿਸ ਸਮੇਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਭੰਗੜੇ ਨੂੰ ਖੁਸ਼ੀ ਦਾ ਹਿੱਸਾ ਮੰਨਿਆ ਜਾਂਦਾ ਹੈ